ਗਾਉਣ ਵਿੱਚ ਮੇਰੀ ਸੰਗੀਤ ਦੀ ਪਸੰਦੀਦਾਰ ਸ਼ੈਲੀ ਢਾਡੀ ਵਾਰਾਂ ਹਨ ਮੈਨੂੰ ਢਾਡੀ ਵਾਰਾਂ ਗਾਉਣੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਢਾਡੀ ਵਾਰਾਂ ਮੈਂ ਸਕੂਲ ਟਾਇਮ ਦੀ ਗਾ ਰਹੀ ਹਾਂ ਅਤੇ ਇਸਨੂੰ ਗਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੇਰੇ ਸਕੂਲ ਦੇ ਟੀਚਰ ਵੀ ਮੈਨੂੰ ਢਾਡੀ ਵਾਰਾਂ ਗਾਉਣ ਦੇ ਲਈ ਕਹਿੰਦੇ ਹੁੰਦੇ ਸਨ ਅਤੇ ਉਹਨਾਂ ਨੂੰ ਉਹਨਾਂ ਦੀ ਹਰ ਇੱਕ ਖੁਸ਼ੀ ਮੈਂ ਪੂਰੀ ਕਰਦੀ ਸੀ ਢਾਡੀ ਵਾਰਾਂ ਜਿੱਦਾਂ ਦੀਆਂ ਜਿਵੇਂ ਜੋਧੇ ਦੀਆਂ ਵਾਰਾਂ ਬਾਬਾ ਦੀਪ ਸਿੰਘ ਦੀਆਂ ਢਾਡੀ ਵਾਰਾਂ ਬਚਿੱਤਰ ਸਿੰਘ ਦੀ ਵਾਰ ਬਾਬਾ ਅਜੀਤ ਸਿੰਘ ਦੀ ਵਾਰ ਬਾਬਾ ਫਤਿਹ ਸਿੰਘ ਦੀ ਵਾਰ ਬਾਬਾ ਜ਼ੋਰਾਵਰ ਸਿੰਘ ਦੀ ਵਾਰ ਬਾਬਾ ਜੁਝਾਰ ਸਿੰਘ ਦੀ ਵਾਰ ਗੁਰੂ ਗੋਬਿੰਦ ਸਿੰਘ ਦੀ ਵਾਰ ਇਹ ਢਾਡੀ ਵਾਰਾਂ ਇਹ ਢਾਡੀ ਵਾਰਾਂ ਗਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਅੱਜ ਦੇ ਮਾਹੌਲ ਦੇ ਵਿੱਚ ਇਹ ਢਾਡੀ ਵਾਰਾਂ ਬਹੁਤ ਮਸ਼ਹੂਰ ਹਨ ਅਤੇ ਜਦੋਂ ਵੀ ਅਸੀਂ ਕਿਸੇ ਪ੍ਰੋਗਰਾਮ 'ਤੇ ਜਾਂਦੇ ਹਾਂ ਤਾਂ ਮੇਰੇ ਤੋਂ ਸੰਗਤ ਢਾਡੀ ਵਾਰਾਂ ਸੁਣ ਕੇ ਖੁਸ਼ ਹੁੰਦੀ ਹੈ ਅਤੇ ਅਸੀਂ ਆਪਣੇ ਮਨਪਸੰਦ ਢਾਡੀ ਵਾਰ ਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਾਂ ਸੰਗਤ ਢਾਡੀ ਵਾਰ ਸੁਣ ਕੇ ਸਾਡੇ ਤੋਂ ਬਹੁਤ ਖੁਸ਼ ਹੁੰਦੀ ਹੈ ਅਤੇ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਤੋਂ ਕੋਈ ਆਪਣੀ ਮਨਪਸੰਦ ਢਾਡੀ ਵਾਰ ਕੋਈ ਸੁਣਦਾ ਹੈ ਮੇਰੇ ਮਨ ਨੂੰ ਤਸੱਲੀ ਹੁੰਦੀ ਹੈ ਅਤੇ ਸੰਗਤ ਨੂੰ ਖੁਸ਼ ਕਰਕੇ ਹੀ ਮੈਨੂੰ ਖੁਸ਼ੀ ਮਿਲਦੀ ਹੈ ਜਿੱਦਾਂ ਕਿ ਢਾਡੀ ਵਾਰ ਜੋ ਅੱਜ ਕੱਲ੍ਹ ਅਸੀਂ ਮਸ਼ਹੂਰ ਕਰੀ ਹੋਈ ਹੈ ਜੋ ਸਾਨੂੰ ਸੋਹਣੀ ਲੱਗਦੀ ਹੈ ਗਾਉਣ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਫਤਿਹ ਪਿਤਾ ਨੂੰ ਬੁਲਾ ਕੇ ਆਖਰੀ ਇੱਦਾਂ ਦੀ ਢਾਡੀ ਵਾਰ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦੀ ਹੈ ਇਹ ਸਾਡਾ ਢਾਡੀ ਵਾਰਾਂ ਸਾਡੇ ਕਮਾਈ ਦਾ ਸਾਧਨ ਹਨ ਇਸਦੇ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਹੈ ਢਾਡੀ ਵਾਰਾਂ ਗਾਉਣ ਦੇ ਨਾਲ ਸਾਨੂੰ ਅਤੇ ਸੰਗਤ ਨੂੰ ਅਤੇ ਸਾਡੇ ਮਨ ਨੂੰ ਤਸੱਲੀ ਹੁੰਦੀ ਹੈ ਅਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਕੋਈ ਸਾਡੇ ਢਾਡੀ ਵਾਰਾਂ ਗਾਉਣ ਦੇ ਨਾਲ ਕੋਈ ਖੁਸ਼ ਹੁੰਦਾ ਹੈ